ਮੈਂ ਪਹਿਲੇ ਜ਼ਮਾਨੇ ਅਤੇ ਹੁਣ ਦੇ ਜ਼ਮਾਨੇ ਦੀ ਗੱਲ ਕਰਨ ਲੱਗੀ ਹਾਂ ਜਿਸ ਵਿੱਚ ਮੈਂ ਦੱਸਾਂਗੀ ਪਹਿਲਾਂ ਰਸੋਈ ਵਿੱਚ ਕੀ ਕੀ ਯੂਜ ਹੁੰਦਾ ਸੀ ਅਤੇ ਹੁਣ ਕੀ ਕੀ ਯੂਜ ਹੁੰਦਾ ਹੈ ਅਤੇ ਕਿੰਨਾ ਉਹਦੇ ਵਿੱਚ ਚੇਂਜ ਹੋ ਚੁੱਕਾ ਹੈ ਅਤੇ ਹੁਣ ਦੇ ਜ਼ਮਾਨੇ ਵਿੱਚ ਮੈਨੂੰ ਬਹੁਤ ਵਧੀਆ ਐਕਸਪੀਰੀਅਸ ਮਿਲਿਆ ਬਲਕਿ ਹੁਣ ਜ਼ਿਆਦਾ ਵਧੀਆ ਪਹਿਲਾਂ ਨਾਲੋਂ ਕਿਉਂਕਿ ਪਹਿਲਾਂ ਕੀ ਹੁੰਦਾ ਸੀਗਾ ਚੁੱਲ੍ਹਾ ਬਾਲਦੇ ਸੀਗੇ ਲੱਕੜੀਆਂ ਨਾਲ ਬਾਲਦੇ ਸੀਗੇ ਜਿਸ ਨਾਲ ਕਿੰਨਾ ਪਲਿਊਸ਼ਨ ਹੁੰਦਾ ਸੀ ਸਾਡੇ ਸ਼ਹਿਰ ਵਿੱਚ ਔਰ ਉਸ ਪਲਿਊਸ਼ਨ ਕਰਕੇ ਕਿੰਨੇ ਨੁਕਸਾਨ ਹੁੰਦੇ ਸੀਗੇ ਸਾਡੀ ਲਾਈਫ ਦੇ ਵਿੱਚ ਅਤੇ ਹੁਣ ਕੀ ਆ ਗਿਆ ਵਾ ਗੈਸ ਆ ਗਿਆ ਵਾ ਉਸ ਜਿਸ ਨਾਲ ਸਾਡਾ ਟਾਈਮ ਵੀ ਬਚਦਾ ਵਾ ਔਰ ਪਲਿਊਸ਼ਨ ਵੀ ਨਹੀਂ ਹੁੰਦਾ ਔਰ ਚੁੱਲ੍ਹਾ ਬਾਲਣ ਨਾਲ ਪਹਿਲਾਂ ਕਿੰਨਾ ਟਾਈਮ ਵੀ ਵੇਸਟ ਹੁੰਦਾ ਸੀਗਾ ਸਾਡਾ ਅਤੇ ਹੋਰ ਵੀ ਕਿੰਨਾ ਕੁਛ ਇੱਦਾਂ ਹੀ ਜਿਵੇਂ ਪਹਿਲਾਂ ਕੁੰਡੀ ਸੋਟੇ ਨਾਲ ਸਭ ਕੁਛ ਪੀਸਣਾ ਕਿੰਨਾ ਟਾਈਮ ਵੇਸਟ ਹੋਣਾ ਅਤੇ ਹੁਣ ਆਪਾਂ ਸਿੱਧਾ ਇਲੈਕਟਰੀਸਿਟੀ ਦੀਆਂ ਚੀਜ਼ਾਂ ਨੂੰ ਯੂਜ ਕਰਕੇ ਉਹ ਯੂਜ ਕਰ ਲੈਂਦੇ ਹਾਂ ਟਾਈਮ ਆਪਣਾ ਸੇਵ ਕਰ ਲੈਂਦੇ ਮੇਰਾ ਤਾਂ ਇਸ ਨਾਲ ਐਕਸਪੀਰੀਅਸ ਬਹੁਤ ਵਧੀਆ ਰਿਹਾ ਪਹਿਲਾਂ ਤਾਂ ਨੁਕਸਾਨ ਹੀ ਹੁੰਦਾ ਸੀ ਸਾਡਾ ਧੰਨਵਾਦ